ਕਹਿੰਦੇ ਨੇ ਕਿਸੇ ਵੀ ਦੇਸ਼ ਜਾਂ ਸਟੇਟ ਦੀ ਤਰੱਕੀ ਨੂੰ ਜੇ ਤੁਸੀਂ ਨਾਪਣਾ ਹੋਵੇ ਤਾਂ ਉਹਦੀਆਂ ਤਿੰਨ ਚੀਜ਼ਾਂ ਦੇ ਉੱਪਰ ਆਪਣਾ ਤੁਸੀਂ ਫੋਕਸ ਕਰ ਲਓ ਅਤੇ ਉਹਨਾਂ ਦੀ ਡਿਵੈਲਪਮੈਂਟ ਦੇਖ ਲਓ ਅਤੇ ਤੁਹਾਨੂੰ ਸਮਝ ਆ ਜਾਵੇਗੀ ਪਹਿਲੀ ਹੈਗੀ ਹੈ ਸਿੱਖਿਆ ਜਾਣੀ ਕਿ ਐਜੂਕੇਸ਼ਨ ਦੂਜਾ ਹੋ ਗਿਆ ਸਿਹਤ ਸੰਭਾਲ ਜਾਣੀ ਕੇ ਮੈਡੀਕਲ ਅਤੇ ਤੀਸਰਾ ਜਿਹੜਾ ਇਕੋਨਮੀ ਯਾਨੀ ਕਿ ਆਰਥਿਕਤਾ ਜੇ ਤਿੰਨ ਚੀਜ਼ਾਂ ਦੇ ਉੱਤੇ ਕੋਈ ਵੀ ਸਰਕਾਰ ਕੰਮ ਕਰ ਲੈਂਦੀ ਇਟ ਮੀਨਸ ਉਹ ਦੇਸ਼ ਤਰੱਕੀਆਂ 'ਤੇ ਜਾਂ ਉਸ ਰਾਜ ਤਰੱਕੀਆਂ 'ਤੇ ਜਾਵੇਗਾ ਹੀ ਜਾਵੇਗਾ ਮੈਂ ਆਪਣੇ ਪੰਜਾਬ ਦੀ ਆਪਾਂ ਜੇ ਗੱਲ ਕਰ ਲਈਏ ਪੰਜਾਬ ਸਰਕਾਰ ਕਿਵੇਂ ਇਨ੍ਹਾਂ ਤਿੰਨ ਚੀਜ਼ਾਂ ਵਾਂ ਅਤੇ ਤਿੰਨ ਮੁੱਦਿਆਂ 'ਤੇ ਕੰਮ ਕਰਦੀ ਹੈ ਕੀ ਕੀ ਅਗਰ ਉਹਨਾਂ ਦੇ ਆਪਾਂ ਕਹਿ ਸਕਦੇ ਹੈਗੇ ਹਾਂ ਕੀ ਯੋਜਨਾਵਾਂ ਨੇ ਜਿਨ੍ਹਾਂ ਰਾਹੀਂ ਉਹ ਇਹ ਤਿੰਨ ਮੁੱਦਿਆਂ ਦੇ ਉੱਤੇ ਕੰਮ ਕਰ ਰਹੀ ਹੈ ਤਾਂ ਉਹਨਾਂ ਚੋਂ ਇੱਕ ਆ ਜਾਂਦਾ ਸਭ ਤੋਂ ਪਹਿਲਾਂ ਸਿੱਖਿਆ ਦੀ ਆਪਾਂ ਜੇ ਗੱਲ ਕਰੀਏ ਅਤੇ ਪੜ੍ਹਾਈ ਵਾਸਤੇ ਸਰਕਾਰੀ ਸਕੂਲ ਨੇ ਜਿਹੜੇ ਛੋਟੇ ਤਬਕੇ ਦੇ ਲੋਕ ਨੇ ਜਿਹੜੇ ਗਰੀਬ ਤਬਕਾ ਹੈ ਆਪਾਂ ਕਹਿ ਲਈਏ ਕਮਜ਼ੋਰ ਵਰਗ ਆ ਆਰਥਿਕ ਤੌਰ 'ਤੇ ਉਹਨਾਂ ਨੂੰ ਪੜ੍ਹਾਈ ਤੋਂ ਵਾਂਝਾ ਨਾ ਰਹਿਣਾ ਪਵੇ ਸਰਕਾਰੀ ਸਕੂਲ ਦੇ ਵਿੱਚ ਉਹਨਾਂ ਦੀ ਪੜ੍ਹਾਈ ਲਗਭਗ ਫਰੀ ਹੀ ਹੈ ਉਸ ਤੋਂ ਇਲਾਵਾ ਉਹਨਾਂ ਨੂੰ ਨਾਲ ਦਿੱਤ ਰਿਹਾ ਉਹਦਾ ਖਾਣਾ ਵੀ ਦਿੱਤਾ ਜਾਂਦਾ ਹੈ ਮਿਡ ਡੇ ਮੀਲ ਦੇ ਥਰੂ ਦੂਜਾ ਵੀ